ਹੈਲੋ ਸਤਿ ਸ਼੍ਰੀ ਅਕਾਲ ਭਾਜੀ ਤੁਸੀਂ ਪ੍ਰੀਤ ਮੋਬਾਇਲ ਸ਼ੋਪ ਤੋਂ ਬੋਲ ਰਹੇ ਹੋ ਹਾਂਜੀ ਜਿਹੜਾ ਤੁਸੀਂ ਮੈਨੂੰ ਫੋਨ ਡਿਲੀਵਰ ਕੀਤਾ ਏ ਆ ਹਾਂਜੀ ਇੱਕ ਤਾਂ ਉਹਦੀ ਡਿਲੀਵਰੀ ਬਹੁਤ ਜ਼ਿਆਦਾ ਲੇਟ ਆਈ ਹੈ ਇੱਕ ਹਫਤਾ ਲੇਟ ਤੁਸੀਂ ਮੈਨੂੰ ਫੋਨ ਡਿਲੀਵਰ ਕੀਤਾ ਅਤੇ ਜਿਹੜੀ ਉਹਦੀ ਪੈਕਜਿੰਗ ਸੀ ਉਹ ਵੀ ਬਿਲਕੁਲ ਤੁਸੀਂ ਵਧੀਆ ਤਰੀਕੇ ਨਾਲ਼ ਨਹੀਂ ਕੀਤੀ ਹੋਈ ਸੀ ਜਦੋਂ ਮੈਂ ਨਾ ਫੋਨ ਨੂੰ ਓਪਨ ਕਰਿਆ ਤਾਂ ਉਹਦਾ ਗਲਾਸ ਗਾਡ ਵੀ ਜਿਹੜਾ ਉਹ ਟੁੱਟਿਆ ਹੋਇਆ ਸੀ ਹਾਂਜੀ ਅਤੇ ਫੋਨ ਦੇ ਜਿਹੜੀ ਪ੍ਰੋਸੈਸਿੰਗ ਉਹ ਬਹੁਤ ਜ਼ਿਆਦਾ ਸਲੋਅ ਚੱਲ ਰਿਹਾ ਫੋਨ ਬਹੁਤ ਜ਼ਿਆਦਾ ਹੈਂਗ ਹੋ ਰਿਆ ਏ ਅਤੇ ਫੋਨ ਦੀ ਬੈਕ ਕੈਮਰਾ ਅਤੇ ਫਰੰਟ ਕੈਮਰਾ ਦੀ ਕੁਆਲਿਟੀ ਵੀ ਬਿਲਕੁਲ ਵਧੀਆ ਨਹੀਂ ਹੈਗੀ ਅਤੇ ਬਹੁਤ ਜ਼ਿਆਦਾ ਸਲੋਅ ਚਾਰਜ ਹੋ ਰਿਹਾ ਹਾਂਜੀ ਫਿਰ ਤੁਸੀਂ ਮੇਰੇ ਫੋਨ ਨੂੰ ਐਕਸਚੇਂਜ ਕਰਕੇ ਹੀ ਦਿਓ ਕਿਉਂਕਿ ਇਸ ਫੋਨ ਦੇ ਵਿੱਚ ਤਾਂ ਬਹੁਤ ਜ਼ਿਆਦਾ ਖਰਾਬੀਆਂ ਏ ਆ ਹਾਂਜੀ ਜਾ ਤਾਂ ਫਿਰ ਤੁਸੀਂ ਮੈਨੂੰ ਫੋਨ ਪੁਰਾਣਾ ਦੇ ਤਾਂ ਆ ਜਾ ਫਿਰ ਤੁਸੀਂ ਮੈਨੂੰ ਸਮਝ ਨਹੀਂ ਆ ਰਹੀ ਕਿ ਤੁਸੀਂ ਕੀ ਕੀਤਾ ਇਸਦੇ ਵਿੱਚ ਤੁਸੀਂ ਮੈਨੂੰ ਪਲੀਜ਼ ਫੋਨ ਐਕਸਚੇਂਜ ਕਰਕੇ ਹੀ ਔਡਰ ਕਰਿਓ ਹਾਂਜੀ ਠੀਕ ਹੈ ਜੀ